ਹੈਲੋ ਵੀਰੇ ਸਤਿ ਸ਼੍ਰੀ ਅਕਾਲ ਸਾਡੇ ਕੋਲ ਤੁਸੀਂ ਕੋਈ ਵੀ ਖਾਣ ਪੀਣ ਦਾ ਸਮਾਨ ਭੇਜ ਦਿਓ ਸਾਨੂੰ ਬਹੁਤ ਭੁੱਖ ਲੱਗੀ ਹੈ ਐਂ ਜਿਸਦੇ ਵਿੱਚ ਚੰਗੀ ਮਟਰ ਪਨੀਰ ਦੀ ਸਬਜ਼ੀ ਚੰਗੇ ਚਾਰ ਫੁਲਕੇ ਔਰ ਸਬਜ਼ੀ ਦਾਲ ਮੀਟ ਭੇਜ ਸਕਦੇ ਹੋ ਤਾਂ ਉਹ ਵੀ ਭੇਜ ਦਿਓ ਅਤੇ ਨਾਲ ਛੋਟਾ ਮੋਟਾ ਹੋਰ ਸਮਾਨ ਪੈਕ ਕਰਕੇ ਤੁਸੀਂ ਸਾਡੇ ਕੋਲ ਭੇਜ ਕੇ ਅਤੇ ਹਾਂ ਇੱਕ ਇਹ ਨਹੀਂ ਭੁੱਲਣਾ ਵਿੱਚ ਸਲਾਦ ਵਗੈਰਾ ਜ਼ਰੂਰ ਭੇਜ ਦਿਓ ਜਿਹਦੇ ਵਿੱਚ ਖੀਰਾ ਪਿਆਜ ਟਮਾਟਰ ਔਰ ਇੱਕ ਨਾਲ ਨਮਕਦਾਨੀ ਔਰ ਭੇਜ ਕੇ ਫ਼ਲ ਫਰੂਟ ਵੀ ਸਾਨੂੰ ਭੇਜਣ ਦੀ ਕ੍ਰਿਪਾਲਤਾ ਕਰਨੀ ਅਸੀਂ ਤੁਹਾਡੀ ਕਾਫ਼ੀ ਦੇਰ ਤੋਂ ਇੰਤਜ਼ਾਰ ਕਰ ਰਹੇ ਹਾਂ ਭੇਜ ਕੇ ਸਾਡੇ ਉੱਤੇ ਆਪਣਾ ਅਹਿਸਾਨ ਜਤਾਓ ਔਰ ਜੋ ਵੀ ਹੋ ਸਕੇ ਅਸੀਂ ਤੁਹਾਡੇ ਕੋਲ ਪੱਕੇ ਤੋਰ 'ਤੇ ਹੀ ਆਪਣਾ ਖਾਣਾ ਲੈ ਕੇ ਜਾਂਦੇ ਹਾਂ ਔਰ ਅੱਜ ਤੁਸੀਂ ਉਸਨੂੰ ਭੇਜਣ ਦੀ ਕ੍ਰਿਪਾਲਤਾ ਕਰਨੀ